ਰੋਪੜ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦਰਿਆ 'ਤੇ ਹੈੱਡ ਲੱਗਿਆ ਹੋਇਆ ਹੈ ਜਿੱਥੇ ਕਿ ਲੋਕ ਘੁੰਮਣ ਆਉਂਦੇ ਹੈ ਅਤੇ ਉਹਦਾ ਵਿਊ ਬਹੁਤ ਸੋਹਣਾ ਹੈ ਅਗਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਇੱਧਰ ਨੂੰ ਬਜ਼ਾਰ ਵੱਲ ਨੂੰ ਹੈ ਅਤੇ ਉਹਦੇ ਨਾਲ ਹੀ ਥੋੜ੍ਹਾ ਜਿਹਾ ਨਾਲ ਲਾਗੇ ਹੀ ਮਹਾਰਾਜਾ ਰਣਜੀਤ ਸਿੰਘ ਬਾਗ਼ ਹੈ ਉੱਥੇ ਵੀ ਲੋਕ ਬਹੁਤ ਘੁੰਮਣ ਆਉਂਦੇ ਆ ਅਤੇ ਉੱਥੇ ਵੀ ਪਾਰਕਿੰਗ ਵਗੈਰਾ ਪਾਰਕ ਬਣੇ ਹੋਏ ਆ ਫੁੱਲ ਬੂਟੀਆਂ ਬਹੁਤ ਸੋਹਣੇ ਲੱਗੇ ਵੀਆ ਤੀਆ ਜੇ ਮਨੋਰੰਜਨ ਦੀ ਗੱਲ ਕਰੀਏ ਤਾਂ ਮੂਵੀਜ ਵਗੈਰਾ ਦੇ ਲਈ ਉੱਥੇ ਬਜ਼ਾਰ ਵਿੱਚ ਥੋੜ੍ਹਾ ਜਿਹਾ ਉਸ ਤੋਂ ਅੱਗੇ ਆਈਏ ਤਾਂ ਕਲਿਆਣ ਸਿਨਮਾ ਹੈ ਜੇ ਆਰ ਥੀਏਟਰ ਆ ਜਿਸ ਵਿੱਚ ਕਿ ਇੱਕ ਟਾਈਮ ਵਿੱਚ ਤਿੰਨ ਤਿੰਨ ਮੂਵੀਆਂ ਦਿਖਾਈਆਂ ਜਾਂਦੀਆਂ ਹਨ